ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਲਗਾਤਾਰ ਸਕਰੀਨ ਉੱਤੇ ਕੰਮ ਕਰਨ ਨਾਲ ਸਾਡਾ ਸਰੀਰ ਥੱਕ ਜਾਂਦਾ ਹੈ ਅਤੇ ਅੱਖਾਂ ਵੀ ਥੱਕਦੀਆਂ ਹਨ ਇਸ ਤਰ੍ਹਾਂ ਹੀ ਇੱਕ ਵਾਰ ਮੇਰੇ ਸਕਰੀਨ ਸਕਰੀਨ 'ਤੇ ਲਗਾਤਾਰ ਕੰਮ ਕਰਨ ਨਾਲ ਮੇਰੀਆਂ ਅੱਖਾਂ ਦੁਖਣ ਲੱਗ ਪਈਆਂ ਅਤੇ ਅਤੇ ਮੈਂ ਬਹੁਤ ਹੀ ਬੋਰੀਅਤ ਜਾ ਸਾਹਮਣਾ ਕੀਤਾ ਅਤੇ ਜਦੋਂ ਸਾਨੂੰ ਇਹ ਸਾਹਮਣਾ ਕਰਨਾ ਪੈਂਦਾ ਹੈ ਇਹ ਇਸ ਤਰ੍ਹਾਂ ਦੀ ਬੋਰੀਅਤ ਦਾ ਤਾਂ ਮੈਂ ਉੱਠ ਕੇ ਥੋੜ੍ਹਾ ਜਿਹਾ ਬਾਹਰ ਜਾ ਕੇ ਔਫਿਸ ਤੋਂ ਬਾਹਰ ਜਾਕਰ ਇੱਧਰ ਉੱਧਰ ਥੋੜ੍ਹੀ ਜਿਹੀ ਹਵਾ ਲੈਂਦਾ ਹਾਂ ਅਤੇ ਥੋੜ੍ਹਾ ਜਿਹਾ ਸੈਰ ਕਰਕੇ ਆਪਣੇ ਆਪ ਨੂੰ ਬਾਕੀ ਚੀਜ਼ਾਂ 'ਚ ਰੁਝਾਉਂਦਾ ਹਾਂ ਜਿਸ ਨਾਲ ਮੇਰੇ ਸਰੀਰ ਅਤੇ ਅੱਖਾਂ ਨੂੰ ਥੋੜ੍ਹਾ ਜਿਹਾ ਚੰਗਾ ਮਹਿਸੂਸ ਹੁੰਦਾ ਹੈ ਜਿਸ ਨਾਲ ਮੇਰੀ ਬੋਰੀਅਤ ਵੀ ਹਟਦੀ ਹੈ ਅਤੇ ਮੇਰੇ ਸਰੀਰ ਨੂੰ ਵੀ ਚੰਗਾ ਫਿ ਅ ਚੰਗਾ ਸ ਸਾਹ ਆਉਂਦਾ ਹੈ ਅਤੇ ਅਕਸਰ ਜਦੋਂ ਵੀ ਮੈਂ ਫੋਨ ਸਕਰੀਨ ਅਤੇ ਲਪ ਲੈਪਟਾਪ 'ਤੇ ਕੰਮ ਕਰਦੇ ਹੋਏ ਬੋਰੀਅਤ ਦਾ ਸਾਹਮਣਾ ਕਰਦਾ ਹਾਂ ਤਾਂ ਮੈਂ ਆਪਣੇ ਸਰੀਰ ਨੂੰ ਚੰਗਾ ਸਹਾਇਆ ਕਰਾਉਣ ਲਈ ਇਸ ਤਰ੍ਹਾਂ ਦੀ ਕੰਮ ਕਰਦਾ ਜਿਵੇਂ ਕਿ ਉੱਠ ਕੇ ਥੋੜ੍ਹਾ ਜਿਹਾ ਘੁੰਮਣਾ ਬਾਹਰ ਜਾਣਾ ਸੈਰ ਕਰਨੀ ਆਦਿ